ਦੇਖੋ ਜੀ ਰਾਜਨੀਤੀ ਬਾਰੇ ਮੈਂ ਇੰਨਾ ਇੰਟਰਸਟ ਨਹੀਂ ਰੱਖਦਾ ਲੇਕਿਨ ਮੈਂ ਮੌਜੂਦਾ ਹਾਲਾਤ ਵਿੱਚ ਜਿਹੜੀਆਂ ਅਸੀਂ ਅਖਬਾਰਾਂ ਪੜ੍ਹਦੇ ਹਾਂ ਜਾਂ ਟੀ ਵੀ ਦੇਖਦੇ ਹਾਂ ਜਿਹਦੇ ਲਈ ਮੋਦੀ ਜੀ ਦੇਸ਼ ਲਈ ਬਹੁਤ ਹੀ ਸਹੀ ਕੰਮ ਕਰ ਰਹੇ ਨੇ ਬਹੁਤ ਹੀ ਵਧੀਆ ਕੰਮ ਕੀਤੇ ਨੇ ਜਿਹਦੇ ਨਾਲ ਦੁਨੀਆ ਬਹੁਤ ਹੀ ਮੋਦੀ ਜੀ ਨੂੰ ਚਾਹੁੰਦੀ ਹੈ ਅਤੇ ਜਿਹਦੇ ਵਿੱਚੋਂ ਮੋਦੀ ਜੀ ਵੀ ਆਪਣੇ ਪੂਰੇ ਭਾਰਤ ਲਈ ਬਹੁਤ ਹੀ ਵਧੀਆ ਕੰਮ ਕੀਤੇ ਨੇ ਵੀ ਜਿਹੜੇ ਵੀ ਅੱਜ ਤੱਕ ਨਹੀਂ ਹੋਏ ਉਹ ਵੀ ਕੰਮ ਕੀਤੇ ਨੇ ਇਸ ਲਈ ਇਹ ਤ ਤੀਸਰੀ ਵਾਰ ਵਾਰ ਲੱਗਦਾ ਹੈ ਫਿਰ ਜਿੱਤ ਜਾਣਗੇ ਅਤੇ ਜਿਹਦੇ ਵਿੱਚੋਂ ਮੋਦੀ ਜੀ ਨੂੰ ਬਹੁਤੀ ਦੁਨੀਆ ਲਾਇਕ ਕਰਦੀ ਹੈ ਜਿਹਦੇ ਵਿੱਚ ਉਹ ਲਾਈਕ ਕਰਨ ਯੋਗ ਹੈ ਵੀ ਹੈ